ਹਾਂਜੀ ਗੁਡ ਆਫਟਰਨੂਨ ਸਰ ਮੈਂ ਸਿੱਧੂ ਨਿਊਜ਼ ਤੋਂ ਜੈਸਮੀਨ ਬੋਲ ਰਹੀ ਹਾਂ ਅੱਜ ਮੈਂ ਥੋੜ੍ਹੀ ਜਿਹੀ ਕੁਐਰੀ ਕਰਨੀ ਹੈ ਹੁਸ਼ਿਆਰਪੁਰ ਦੇ ਬਾਰੇ ਤੁਸੀਂ ਆਪਣਾ ਇੰਟਰੋਡਕਸ਼ਨ ਦੇ ਸਕਦੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਹੀ ਬੋਲਦੇ ਹੋ ਠੀਕ ਹੈ ਤੁਸੀਂ ਮੈਨੂੰ ਮਲ ਕਿ ਅੱਜ ਮੈਨੂੰ ਦੱਸ ਸਕਦੇ ਹੋ ਕਿ ਹੁਸ਼ਿਆਰਪੁਰ 'ਚ ਕਿਹੜੇ ਫੈਸਟੀਵਲ ਹੈ ਜਿਹੜੇ ਲੋਕ ਬਹੁਤ ਮਤਲਬ ਕਿ ਵਧੀਆ ਧੂਮਧਾਮ ਨਾਲ ਉੱਥੇ ਮਨਾਏ ਜਾਂਦੇ ਆ ਹੂੰ ਹੂੰ ਤੁਸੀਂ ਮੈਨੂੰ ਸ਼ੋਭਾ ਯਾਤਰਾ ਬਾਰੇ ਕੀ ਦੱਸੋਗੇ ਕਿਉਂਕਿ ਜਦੋਂ ਸ਼ੋਭਾ ਯਾਤਰਾ ਆਪਾਂ ਕੱਢਦੇ ਹੁੰਦੇ ਹਾਂ ਹਰ ਫੈਸਟੀਵਲ 'ਤੇ ਉਹ ਕਿਆ ਹੁਸ਼ਿਆਰਪੁਰ 'ਚ ਕੱਢੀ ਜਾਂਦੀ ਹੈ ਅਤੇ ਕੀ ਇਹ ਨੂੰ ਲੈ ਕੇ ਮਲ ਕਿ ਕਿੱਦਾਂ ਕਿੱਦਾਂ ਜਾਂਦੇ ਨੇ ਲੋਕ ਪਸੰਦ ਕਰਦੇ ਨੇ ਕਿੱਦਾਂ ਤੁਹਾਨੂੰ ਹੁਸ਼ਿਆਰਪੁਰ ਦਾ ਮਤਲਬ ਸਭ ਤੋਂ ਵਧੀਆ ਜੇ ਤੁਸੀਂ ਕਹੋ ਕਿ ਹਾਂ ਇਹ ਤਿਉਹਾਰ ਸਭ ਤੋਂ ਵਧੀਆ ਲੱਗਦਾ ਸਾਨੂੰ ਜਦੋਂ ਹੁਸ਼ਿਆਰਪੁਰ 'ਚ ਆਉਂਦਾ ਅਤੇ ਉਦੋਂ ਬਹੁਤ ਵਧੀਆ ਲੱਗਦਾ ਆਸੇ ਪਾਸੇ ਇਹੋ ਜਿਹੇ ਕਿਹੜੇ ਤਿਉਹਾਰ ਨੂੰ ਤੁਸੀਂ ਮਲ ਕਿ ਕਹੋਗੇ ਕਿ ਜਦੋਂ ਹੁਸ਼ਿਆਰਪੁਰ 'ਚ ਇਹ ਤਿਉਹਾਰ ਆਉਂਦਾ ਤਾਂ ਉਦੋਂ ਹੁਸ਼ਿਆਰਪੁਰ 'ਚ ਰੋਣਕਾਂ ਲੱਗ ਜਾਂਦੀਆਂ ਨੇ ਤੁਸੀਂ ਕਿਸ ਮਲ ਕਿ ਸਪੈਸੀਫਿਕ ਤਿਉਹਾਰ ਨੂੰ ਕਹਿਣਾ ਚਾਹੁੰਦੇ ਹੋ

ਹੋਰ ਕੋਈ ਮਤਲਬ ਕਿ ਕੋਈ ਤਿਉਹਾਰ ਜਿਹੜਾ ਹੁਸ਼ਿਆਰਪੁਰ ਮਤਲਬ ਕਿ ਆਪਣੇ ਮਲ ਕਿ ਵਧੀਆ ਮਲ ਕਿ ਜਿਹਨੂੰ ਕਹਿੰਦੇ ਆਪਾਂ ਕਿ ਜਿਹਦੇ ਪਿੱਛੇ ਉਹ ਕਹਿੰਦੇ ਹਾਂ ਕਿ ਹੂੰ ਹੂੰ

ਹੂੰ ਹੂੰ

ਹੂੰ ਹੂੰ ਮਤਲਬ ਜੇ ਤੁਸੀਂ ਕਹੋ ਕਿ ਪਲਿਊਸ਼ਨ ਜਿਹੜਾ ਆਪਣਾ ਹੁਸ਼ਿਆਰਪੁਰ ਦੇ ਲੋਕ ਮਲ ਕਿ ਕਿਹੜੇ ਫੈਸਟੀਵਲ ਦੇ ਵਿੱਚ ਯਾਨੀ ਕਿ ਸਭ ਤੋਂ ਜ਼ਿਆਦਾ ਇਹਨੂੰ ਕਹਿੰਦੇ ਆ ਅਨਹਾਈਜਿਨਿਕ ਕਰ ਦਿੰਦੇ ਆ ਅਤੇ ਉਹ ਨਾ ਬਹੁਤ ਪੋਲਿਊਟਡ ਕਰ ਦਿੰਦੇ ਆ ਆਪਣੇ ਏਰੀਆ ਨੂੰ

ਹੂੰ ਹੂੰ ਵੰਨ ਔਫ ਦਾ ਹਾਈਜੀਨਿਕ ਫੈਸਟੀਵਲ ਜਿਹਨੂੰ ਕਹੋਗੇ ਕਿ ਜਿਹੜਾ ਥੋੜ੍ਹਾ ਮਤਲਬ ਕਿ ਸਹੀ ਵੀ ਆ ਅਤੇ ਜਿਸ ਨਾਲ ਇਨਵਾਇਰਮੈਂਟ ਵੀ ਗੰਦਾ ਨਹੀਂ ਹੁੰਦਾ ਅਤੇ ਬਹੁਤ ਵਧੀਆ ਤਰੀਕੇ ਨਾਲ ਹੁਸ਼ਿਆਰਪੁਰ ਦੇ ਲੋਕ ਜਿਹੜੇ ਆ ਧੂਮਧਾਮ ਨਾਲ ਮਨਾਉਂਦੇ ਆ ਅਤੇ ਵਧੀਆ ਵੀ ਲੱਗਦਾ ਅਤੇ ਉਹ ਨਾਲ ਗੰਦਗੀ ਵੀ ਨਹੀਂ ਫੈਲਦੀ ਇਹੋ ਜਿਹਾ ਕਿਹੜਾ ਤਿਉਹਾਰ ਤੁਸੀਂ ਮੈਨੂੰ ਦੱਸੋਗੇ ਵੀ ਹੁਸ਼ਿਆਰਪੁਰ 'ਚ ਇਹ ਤਿੁੳਹਾਰ ਨਾਲ ਗੰਦਗੀ ਨਹੀਂ ਫੈਲਦੀ ਅਤੇ ਬਹੁਤ ਵਧੀਆ ਹੈ ਹੂੰ ਹੂੰ

ਠੀਕ ਹੈ ਸਰ ਥੈਂਕ ਯੂ ਹੋਰ ਕੋਈ ਤੁਸੀਂ ਆਪਣਾ ਕੋਈ ਸਜੈਸ਼ਨ ਦੇਣਾ ਚਾਹੋਗੇ ਕਿ ਕੁਛ ਵੀ ਜੇ ਆਪਾਂ ਹੁਸ਼ਿਆਰਪੁਰ ਆਈਏ ਤਾਂ ਅਸੀਂ ਕਿਹੜਾ ਤਿਉਹਾਰ ਮਨਾਈਏ ਅਸੀਂ ਆ ਕੇ ਉੱਥੇ ਅਤੇ ਸਾਨੂੰ ਪਤਾ ਲੱਗੇ ਕਿ ਇਹ ਹੁਸ਼ਿਆਰਪੁਰ ਦਾ ਤਿਉਹਾਰ ਸੀਗਾ ਇਹਨੂੰ ਮਨਾਇਆ ਜਾਵੇ ਅਤੇ ਆਪਾਂ ਅੱਗੇ ਜਾ ਕੇ ਵੀ ਉਹਨੂੰ ਮਲ ਕਿ ਅਕਸਪੋਜ਼ ਕਰੀਏ ਕਿ ਹਾਂ ਵੀ ਹੁਸ਼ਿਆਰਪੁਰ ਦਾ ਤਿੁੳਹਾਰ ਸੀਗਾ ਆਪਾਂ ਉੱਥੋਂ ਆਏ ਹਾਂ ਅਤੇ ਤੁਹਾਡੇ ਅਕੋਰਡਿੰਗ ਕਿਹੜੀ ਸਜੈਸ਼ਨ ਤੁਸੀਂ ਮੈਨੂੰ ਦਿਉਗੇ ਕਿ ਤੁਸੀਂ ਆਇਓ ਅਤੇ ਸਾਡੇ ਹੁਸ਼ਿਆਰਪੁਰ ਇਹ ਵਾਲਾ ਤਿਉਹਾਰ ਆ ਕੇ ਮਨਾ ਕੇ ਜਾਇਓ ਦੇਖ ਕੇ ਜਾਇਓ ਜਿਹਨੂੰ ਕਹੋਗੇ ਓਕੇ ਸਰ ਥੈਂਕ ਯੂ ਸਰ